ਯੂ ਪੀ ਆਈ ਨੇ ਭਾਰਤ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਯੂ ਪੀ ਆਈ ਦੀ ਵਰਤੋਂ ਨਾਲ ਲੋਕਾਂ ਦੀ ਕਈ ਪ੍ਰੇਸ਼ਾਨੀਆਂ ਵੀ ਦੂਰ ਹੋ ਗਈਆਂ ਹੈ ਜੋ ਕਿ ਲੋਕ ਰੋਜ਼ ਬੈਂਕਾਂ 'ਚੋਂ ਪੈਸੇ ਕਢਵਾਉਣ ਜਾਂਦੇ ਸੀ ਹੁਣ ਉਹ ਹੀ ਚੀਜ਼ਾਂ ਯੂ ਪੀ ਆਈ ਤੋਂ ਹੋਣ ਲੱਗ ਪਈਆਂ ਹਨ ਅੱਜ ਕੱਲ੍ਹ ਤਾਂ ਯੂ ਪੀ ਆਈ 'ਚ ਹਰ ਕਿਸੇ ਦਾ ਅਕਾਊਂਟ ਹੈਗਾ ਭਾਵੇਂ ਉਹ ਰੇਹੜੀ ਵਾਲਾ ਹੈ ਭਾਵੇਂ ਉਹ ਗੋਲ ਗੱਪੇ ਵਾਲਾ ਹੈ ਭਾਵੇਂ ਉਹ ਰਿਕਸ਼ੇ ਵਾਲਾ ਕਿਓਂ ਨਹੀਂ ਜੇਕਰ ਤੁਸੀਂ ਮੇਰੀ ਗੱਲ ਕਰਦੇ ਹੋ ਤਾਂ ਅੱਜ ਕੱਲ੍ਹ ਮੈਨੂੰ ਪਰਸ ਫੜਨ ਦੀ ਤਾਂ ਕਦੇ ਲੋੜ ਪਈ ਹੀ ਨਹੀਂ ਜੇਕਰ ਮੈਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਇੱਕ ਸਿਰਫ਼ ਮੋਬਾਈਲ ਦੀ ਹੈ ਮੈਂ ਚਾਹੇ ਕੋਈ ਕੱਪੜੇ ਲੈਣੇ ਹੈ ਚਾਹੇ ਕੋਈ ਜੁੱਤੀ ਲੈਣੀ ਹੈ ਭਾਵੇਂ ਮੈਂ ਕੋਈ ਗੋਲ ਗੱਪੇ ਚਾਟ ਹੀ ਕਿਓਂ ਨਾ ਖਾਣੀ ਹੋਵੇ ਮੈਂ ਹਰ ਵੇਲੇ ਹਰ ਥਾਂ 'ਤੇ ਯੂ ਪੀ ਆਈ ਦੀ ਵਰਤੋਂ ਹੀ ਕਰਦੀ ਹਾਂ ਯੂ ਪੀ ਆਈ ਨਾਲ ਹਰ ਕੰਮ ਅਸਾਨ ਹੋ ਗਿਆ ਹੈ ਅੱਜ ਕੱਲ੍ਹ ਯੂ ਪੀ ਆਈ ਦੇ ਹੋਣ ਨਾਲ ਤਾਂ ਲੋਕਾਂ ਦੀ ਇੰਨੀਆਂ ਮੁਸ਼ਕਿਲਾਂ ਅਸਾਨ ਹੋ ਗਈਆਂ ਹਨ ਕਿ ਕੋਈ ਵੀ ਲੋਕ ਪੈਸੇ ਚੁੱਕਣਾ ਤਾਂ ਪਸੰਦ ਕਰਦੇ ਹੀ ਨਹੀਂ ਹੈਗੇ